ਹਾਂਜੀ ਅਸੀਂ ਬਠਿੰਡੇ ਐਕਟੀਵਿਟੀ ਕਲੱਬ ਤੋਂ ਬੋਲ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸੋ ਆਪਣੇ ਕੋਲ ਜੀ ਐਕਟੀਵਿਟੀ ਹੈਗੀ ਆ ਭੰਗੜਾ ਹੈਗੇ ਆ ਡਾਂਸ ਹੈਗਾ ਅਤੇ ਮਤਲਬ ਗੇਮਜ ਹੈਗੀਆਂ ਕੰਪਟੀਸ਼ਨ ਗੇਮਜ ਹੈਗੀਆਂ ਸਵੀਮਿੰਗ ਹੈਗਾ ਸਪੀਚ ਹੈਗੀ ਆ ਬੱਚੇ ਨੂੰ ਮਤਲਬ ਹਰ ਇੱਕ ਤਰ੍ਹਾਂ ਦੀ ਐਕਟੀਵਿਟੀ ਹੈਗੀ ਹੈ ਜੀ ਹਾਂਜੀ ਜ਼ਰੂਰ ਕਿੰਨੇ ਬੱਚੇ ਆਪਣੇ ਅੱਛਾ ਜੀ ਕਿੰਨੀ ਏਜ ਹੈ ਕਿਹੜੀ ਕਲਾਸ 'ਚ ਪੜ੍ਹਦੇ ਨੇ ਅੱਛਾ ਜੀ ਕੋਈ ਨਾ ਜੀ ਜਦੋਂ ਮਰਜ਼ੀ ਪਾਓ ਅੱਛਾ ਜੀ ਤੁਸੀਂ ਮਤਲਬ ਮੈਮ ਕਿਹੜੀ ਐਕਟੀਵਿਟੀ 'ਚ ਪਾਉਣਾ ਚਾਹੁੰਦੇ ਹੋ ਕਿਹੜੇ ਬੱਚੇ ਨੂੰ ਅੱਛਾ ਜੀ ਅੱਛਾ ਜੀ ਕੋਈ ਨਾ ਕੋਈ ਨਾ ਕੋਈ ਨਾ ਤੁਸੀਂ ਜਦੋਂ ਮਰਜ਼ੀ ਕੋਈ ਮਰਜ਼ੀ ਐਕਟੀਵਿਟੀ 'ਚ ਪਾਓ ਹਾਂਜੀ ਆਪਣੇ ਮਤਲਬ ਛੋਟੇ ਬੱਚੇ ਦੀ ਫੀਸ ਤਾਂ ਹੈਗੀ ਜੀ ਤਿੰਨ ਹਜ਼ਾਰ ਰੁਪਏ ਵੱਡੇ ਦੀ ਹੈਗੀ ਹੈ ਪੰਜ ਹਜ਼ਾਰ ਰੁਪਏ ਹਾਂਜੀ ਹਾਂਜੀ ਤੁਸੀਂ ਬੱਚਿਆਂ ਨੂੰ ਜਦੋਂ ਮਰਜ਼ੀ ਕੱਲ੍ਹ ਨੂੰ ਕਰਵਾ ਦਿਓ ਚਾਹੇ ਅੱਜ ਕਰਵਾਓ ਚਾਹੇ ਪਰਸੋਂ ਤੋਂ ਕਦੋਂ ਮਰਜ਼ੀ ਲੈ ਕੇ ਆ ਸਕਦੇ ਹੋ ਅਤੇ ਤੁਸੀਂ ਇਹ ਬਿਲਕੁਲ ਵੀ ਟੈਂਸ਼ਨ ਨਾ ਲਓ ਜੇ ਬੱਚੇ ਮਤਲਬ ਸ਼ਰਾਰਤੀ ਜਿਹੇ ਨੇ ਜਾਂ ਕੁਛ ਵੀ ਨੇ ਕੋਈ ਵੀ ਮਤਲਬ ਕੁਛ ਵੀ ਸ਼ਰਾਰਤ ਹੁੰਦੇ ਕਈ ਬੱਚੇ ਕਈ ਬੋਲਦੇ ਨਹੀਂ ਹੁੰਦੇ ਜਾਂ ਕਈ ਨਹੀਂ ਬੋਲਦੇ ਜੇ ਕਈ ਬੋਲਦੇ ਆ ਤੁਸੀਂ ਟੈਂਸ਼ਨ ਨਾ ਲਓ ਉ ਉਰੇ ਆ ਕੇ ਸਾਡੇ ਐਕਟੀਵੇਟ ਕਲੱਬ ਦੇ ਵਿੱਚ ਆ ਕੇ ਪੂਰਾ ਭਰੋਸਾ ਦਿੰਦੇ ਹਾਂ ਬੱਚਾ ਇੱਕਦਮ ਪਰਫੈਕਟ ਅਤੇ ਵਧੀਆ ਹੋਜੂਗਾ ਹਾਂਜੀ ਤੁਸੀਂ ਭਰੋਸਾ ਰੱਖੋ ਸਾਡੇ 'ਤੇ ਤੁਹਾਡੇ ਬੱਚੇ ਵਧੀਆ ਇੱਕ ਵਧੀਆ ਇੱਕ ਬਹੁਤ ਹੀ ਵਧੀਆ ਹੋਣਹਾਰ ਬੱਚੇ ਬਣਨਗੇ ਤੁਸੀਂ ਟੈਨਸ਼ਨ ਨਾ ਲਓ ਹਾਂਜੀ ਇਹ ਆਪਣੇ 'ਤੇ ਮਤਲਬ ਇਹ ਸਾਡੇ 'ਤੇ ਮਤਲਬ ਆਪਣੇ 'ਤੇ ਡਿਪੈਂਡ ਹੈ ਵੀ ਅਸੀਂ ਬੱਚਿਆਂ ਨੂੰ ਉਹ ਹੀ ਸਿੱਖਿਆ ਦੇਈਏ ਉਹ ਹੀ ਕੁਛ ਬਣਾਈਏ ਜੋ ਬੱਚਿਆਂ ਦਾ ਮਨ ਹੈ ਅਤੇ ਉਹ ਆਪਣੇ ਮਤਲਬ ਘਰਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਅਤੇ ਇਸ ਲਈ ਤਾਂ ਇਹ ਬੱਚਿਆਂ ਵਾਸਤੇ ਸਪੈਸ਼ਲ ਤਿਆਰ ਕੀਤਾ ਗਿਆ ਵੀ ਹਾਂ ਇਹ ਬਠਿੰਡੇ ਵਿੱਚ ਐਕਟੀਵਿਟੀ ਕਲੱਬ ਜੋ ਸਪੈਸ਼ਲ ਬੱਚਿਆਂ ਦੇ ਮਾਇੰਡ ਅਤੇ ਬੱਚਿਆਂ ਦੇ ਲਈ ਤਿਆਰ ਕੀਤਾ ਗਿਆ ਕਿਉਂਕਿ ਬੱਚੇ ਕਿਉਂਕਿ ਘਰ ਦੇ ਵਿੱਚ ਬੱਚੇ ਸ਼ਰਾਰਤ ਕਰਦੇ ਉਹਨੂੰ ਆਪਾਂ ਇੰਨਾ ਮਤਲਬ ਧਿਆਨ ਨਹੀਂ ਦਿੱਤੇ ਉਰੇ ਆ ਕੇ ਇਸ ਲਈ ਐਕਟੀਵਿਟੀ ਕਲੱਬ ਤਿਆਰ ਕੀਤਾ ਗਿਆ ਵੀ ਜੇ ਬੱਚੇ ਸ਼ਰਾਰਤ ਕਰਨਗੇ ਉਹ ਸ਼ਰਾਰਤ ਨੂੰ ਵੀ ਕੰਪੀਟੀਸ਼ਨ ਦੇ ਰੂਪ ਦੇ ਵਿੱਚ ਦਿੱਤੀ ਜਾਵੇ ਹਾਂਜੀ ਤੁਸੀਂ ਕੱਲ੍ਹ ਤੋਂ ਕਰ ਸਕਦੇ ਹੋ ਪਰਸੋਂ ਤੋਂ ਕਰ ਸਕਦੇ ਹੋ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹਾਂਜੀ ਠੀਕ ਹੈ ਜੀ ਓਕੇ ਥੈਂਕ ਯੂ